ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਹਨ ਜੋ ਕਿ ਖੇਡਾਂ ਨੂੰ ਉਤਸ਼ਾਹਿਤ ਕਰਦੀਆਂ ਹਨ ਜਿਵੇਂ ਕਿ ਸਕੂਲਾਂ ਵਿੱਚ ਹੀ ਛੋਟੀ ਕਲਾਸ ਤੋਂ ਹੀ ਬੱਚਿਆਂ ਨੂੰ ਖੇਡਾਂ ਖਿਡਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਸਕੂਲ ਵੱਲੋਂ ਹੀ ਖੇਡਾਂ ਸਿਖਾਉਣ ਲਈ ਸਕੂਲ ਵਿੱਚ ਖੇਡਾਂ ਦੇ ਟੀਚਰ ਜਾਂ ਕੋਚ ਵਗੈਰਾ ਰੱਖੇ ਹੁੰਦੇ ਹਨ ਜੋ ਕਿ ਬੱਚਿਆਂ ਨੂੰ ਖੇਡਾਂ ਬਾਰੇ ਦੱਸਦੇ ਹਨ ਅਤੇ ਉਹ ਖੇਡਾਂ ਦੇ ਮੁਕਾਬਲੇ ਲਈ ਸਟੇਟ ਪੱਧਰ 'ਤੇ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਖੇਡਾਂ ਵਿੱਚ ਹਿੱਸਾ ਲੈਂਦੇ ਹਨ ਜਾਂ ਅਜਿਹੀਆਂ ਸੰਸਥਾਵਾਂ ਪਿੰਡਾਂ ਵਿੱਚ ਵੀ ਹੁੰਦੀਆਂ ਹਨ ਜਿਵੇਂ ਕਿ ਹਰੇਕ ਪਿੰਡ ਵਿੱਚ ਖ ਖੇਡਾਂ ਦੇ ਪ੍ਰਤੀ ਕਲੱਬ ਬਣੇ ਹੁੰਦੇ ਹਨ ਸਾਡੇ ਪਿੰਡ ਵਿੱਚ ਵੀ ਇੱਕ ਅਜਿਹਾ ਕਲੱਬ ਹੈ ਜੋ ਕਿ ਪਿੰਡ ਦੀ ਪੰਚਾਇਤ ਵੱਲੋਂ ਹਰੇਕ ਦੋ ਤਿੰਨ ਮਹੀਨਿਆਂ ਦੇ ਵਿੱਚ ਟੂਰਨਾਮੈਂਟ ਕਰਵਾਏ ਜਾਂਦੇ ਹਨ ਜਿਸ ਵਿੱਚ ਬਹੁਤ ਸਾਰੇ ਬੱਚੇ ਖੇਡਾਂ ਵਿੱਚ ਹਿੱਸਾ ਵੀ ਲੈਂਦੇ ਹਨ ਅਤੇ ਹੋਰ ਵੀ ਪਿੰਡਾਂ ਦੇ ਹੋਰ ਵੀ ਪਿੰਡਾਂ ਦੇ ਬੱਚੇ ਉਸ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੇ ਹਨ ਅਤੇ ਉਹ ਸਾਰਾ ਖ਼ਰਚਾ ਖੇਡਾਂ ਦਾ ਕਲੱਬ ਵੱਲੋਂ ਹੀ ਕੀਤਾ ਜਾਂਦਾ ਜਾਂ ਪਿੰਡ ਦੀ ਪੰਚਾਇਤ ਵੱਲੋਂ ਕੀਤਾ ਜਾਂਦਾ ਹੈ ਜੀ ਹਾਂ ਹਰੇਕ ਪਿੰਡ ਵਿੱਚ ਇਹੋ ਜਿਹੇ ਕਲੱਬ ਜਾਂ ਸੰਸਥਾਵਾਂ ਬਣੀਆਂ ਹੁੰਦੀਆਂ ਹਨ ਜੋ ਕਿ ਬੱਚਿਆਂ ਦੇ ਬੱਚਿਆਂ ਨੂੰ ਖੇਡਾਂ ਖਿਡਾਉਂਦੇ ਹਨ ਜਾਂ ਪਿੰਡ ਵਿੱਚ ਟੂਰਨਾਮੈਂਟ ਕਰਵਾਉਂਦੇ ਹਨ ਜਿਸ ਲਈ ਜਿਸ ਕਾਰਣ ਬੱਚਿਆਂ ਦੀ ਸਰੀਰਕ ਸਰੀਰ ਵੀ ਸਹੀ ਸਹੀ ਰਹੇ ਅਤੇ ਸਿਹਤ ਵੀ ਸਹੀ ਰਹੇ ਜੋ ਕਿ ਬੱਚਿਆਂ ਲਈ ਵੀ ਬਹੁਤ ਲਾਭਦਾਇਕ ਹੁੰਦਾ